ਮੈਂ ਅੱਜ ਤੁਹਾਡੇ ਨਾਲ ਇਲੈਕਟਰੀਕਲ ਫੈਨ ਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਅਸੀਂ ਇੱਕ ਇਲੈਕਟਰੀਕਲ ਫੈਨ ਪੱਖਾ ਲੈਣ ਪੱਖਾ ਲੈਣਾ ਸੀ ਅਤੇ ਅਸੀਂ ਬਹੁਤ ਸਾਰੀਆਂ ਦੁਕਾਨਾਂ 'ਤੇ ਟਰਾਈ ਕੀਤਾ ਪਰ ਸ ਸਾਨੂੰ ਉੱਥੇ ਇੰਨਾ ਦਿਲ ਨੂੰ ਤਸੱਲੀ ਨਹੀਂ ਹੋਈ ਫਿਰ ਅਸੀਂ ਬਹੁਤ ਐ ਸਾਰੀਆਂ ਐਪਾਂ 'ਤੇ ਵੇਖਿਆ ਅਤੇ ਅਸੀਂ ਐਮਾਜੋਨ ਤੋਂ ਇੱਕ ਫੈਨ ਮੰਗਵਾਇਆ ਇਲੈਕਟਰੀਕਲ 'ਤੇ ਸਾਨੂੰ ਉਹ ਬਹੁਤ ਮਤਲਬ ਨਾ ਅਸੀਂ ਸੋਚਦੇ ਸੀ ਕਿ ਬਈ ਅਸੀਂ ਐਪ ਤੋਂ ਔਨਲਾਈਨ ਮੰਗਵਾਵਾਂਗੇ ਤਾਂ ਪਤਾ ਨਹੀਂ ਚੀਜ਼ ਕਿਹੋ ਜਿਹੀ ਨਿਕਲੇਗੀ ਕਿਹੋ ਜਿਹੀ ਨਾ ਨਿਕਲੂਗੀ ਪਰ ਉਹ ਬਹੁਤ ਵਧੀਆ ਨਿਕਲਿਆ ਜਿਹੜਾ ਅਸੀਂ ਕਲਰ ਭੇਜਿਆ ਸੀ ਬਈ ਅਸੀਂ ਮੰਗਵਾਉਣਾ ਹੈ ਉਹ ਸੇਮ ਹੀ ਆਇਆ ਅਤੇ ਪ੍ਰੋਡਕਟ ਅ ਬਹੁਤ ਵਧੀਆ ਸੀ ਨਿਕਲਿਆ ਅਤੇ ਉਹਦੇ ਪਾਰਟ ਵੀ ਬਹੁਤ ਮਜ਼ਬੂਤ ਸੀਗੇ ਹਵਾ ਵੀ ਬਹੁਤ ਵਧੀਆ ਦਿੰਦਾ ਉਹ

ਉਹਦਾ ਰੇਟ ਵੀ ਬਹੁਤ ਮਤਲਬ ਬਾਜ਼ਾਰ ਨਾਲੋਂ ਘੱਟ ਸੀ ਸਾਨੂੰ ਬਹੁਤ ਵਾਜਿਬ ਰੇਟ 'ਤੇ ਉਹ ਮਿਲ ਗਿਆ ਪੱਖਾ ਅਤੇ ਹੁ ਹੁਣ ਅਸੀਂ ਲੋਕ ਅਸੀਂ ਸਾਰਿਆਂ ਨੂੰ ਲੋ ਸਾਰਿਆਂ ਲੋਕਾਂ ਨੂੰ ਵੀ ਦੇ ਇਹ ਹੀ ਸਲਾਹ ਦੇਣਾ ਚਾਹੁੰਦੇ ਹਾਂ ਕਿ ਜੋ ਲੋਕ ਇਹ ਸੋਚਦੇ ਹੈ ਕਿ ਔਨਲਾਈਨ ਸਮਾਨ ਮੰਗਾਵਾਣ ਅ ਮੰਗਵਾਉਂਦੇ ਹਾਂ ਤਾਂ ਕਈ ਵਾਰੀ ਨਹੀਂ ਸਹੀ ਨਿਕਲਦਾ ਪਰ ਆਹ ਅਸੀਂ ਜਿਹੜਾ ਇਸ ਐਪ ਤੋਂ ਸਮਾਨ ਮੰਗਵਾਇਆ ਉਹ ਬਹੁਤ ਵਧੀਆ ਨਿਕਲਿਆ ਮਤਲਬ